ਸਾਰਿਆਂ ਦੀ ਤਰ੍ਹਾਂ ਮੈਂ ਵੀ ਆਪਣੇ ਕੈਰੀਅਰ ਦੇ ਵਿੱਚ ਇੱਕ ਸਟੈਬਿਲਟੀ ਲੱਭ ਰਹੀ ਹਾਂ ਇਸ ਵੇਲੇ ਮੈਂ ਐਥੀਕਲ ਹੈਕਿੰਗ ਦਾ ਕੋਰਸ ਕਰ ਰਹੀ ਹਾਂ ਮੈਂ ਮੇਰੇ ਦਿਮਾਗ ਵਿੱਚ ਐਥੀਕਲ ਹੈਕਿੰਗ ਕਰਨ ਦੇ ਬਾਰਾ ਬਾਰੇ ਤਦੋਂ ਆਇਆ ਜਦੋਂ ਮੈਂ ਇੱਕ ਫਿਲਮ ਦੇਖੀ ਸੀ ਉਸ ਫਿਲਮ ਵਿੱਚ ਐਥ ਹੈਕਿੰਗ ਕਰਦਿਆ ਇੱਕ ਔਫੀਸਰ ਨੇ ਪੂਰੇ ਦੇਸ਼ ਦੀ ਰੱਖਿਆ ਕਰੀ ਸੀ ਅਤੇ ਮੈਨੂੰ ਉਹ ਚੀਜ਼ ਬਹੁਤ ਚੰਗੀ ਲੱਗੀ ਜਿਸ ਕਰਕੇ ਮੈਂ ਸੋਚਿਆ ਕਿ ਮੈਂ ਵੀ ਇੱਕ ਦਿਨ ਇੱਦਾਂ ਦਾ ਕੁਝ ਕਰਾਂਗੀ ਤਾਂ ਜਦ ਮੈਨੂੰ ਮੌਕਾ ਮਿਲਿਆ ਐਥੀਕਲ ਹੈਕਿੰਗ ਕਰਨ ਦਾ ਦੈੱਨ ਮੈਂ ਉਹ ਮੌਕਾ ਉਸੇ ਵਕਤ ਅਪਣਾ ਲਿਆ ਹੈਕਿੰਗ ਹੈਕਿੰਗ ਕਰਦੇ ਹੋਏ ਮੇਰਾ ਸਭ ਤੋਂ ਵੱਡਾ ਇਹੀ ਸੁਪਨਾ ਹੈ ਕਿ ਮੈਨੂੰ ਇੱਕ ਵੱਡਾ ਪਦ ਮਿਲੇ ਅਤੇ ਮੈਂ ਸਰਕਾਰੀ ਨੌਕਰੀ ਕਰਾ ਸਰਕਾਰੀ ਨੌਕਰੀ ਕਰਕੇ ਆਪਣੇ ਮਾਤਾ ਪਿਤਾ ਅਤੇ ਆਪਣਾ ਰਾਂ ਰੌਸ਼ਨ ਕਰਾਂ